ਬਾਈਕਿੰਗ ਨੂੰ ਲੋਕਾਂ ਦਾ ਜਨੂਨ ਕਹਿਣਾ ਇਸ ਲਈ ਸਹੀ ਹੈ ਕਿਉਂਕੀ ਇਸ ਵਿੱਚ ਦਿਲਚਸਪੀ ਅਤੇ ਉਤਸਾਹ ਦੀਆਂ ਦੀ ਭਰਪੂਰ ਅਮੀਰ ਹੁੰਦੀ ਹੈ ਬਾਈਕ ਰਿਕਾਰਡਿੰਗ ਦੇ ਨਾਲ ਜੁੜੀਆਂ ਭਾਵਨਾਵਾਂ ਨੂੰ ਵਰਨਨ ਕਰਦੇ ਹੋਏ ਬਹੁਤ ਸਾਰੇ ਲੋਕਾਂ ਲਈ ਇਹ ਸਿਰਫ ਇੱਕ ਵਾਅਦਾ ਨਹੀਂ ਸਗੋਂ ਇੱਕ ਮੁਕੰਮਲ ਅਨੁਭਵ ਹੁੰਦਾ ਹੈ ਜਿਸ ਵਿੱਚ ਊਰਜਾ ਗਤੀ ਅਟਰਨੇਟ ਲਾਈ ਨਾਈਲ ਐਡਰੇਨਾਈਲ ਦਾ ਜੋਸ਼ ਹੁੰਦਾ ਹੈ ਜਦੋਂ ਤੁਸੀਂ ਬਾਈਕ ਚਲਾਉਂਦੇ ਹੋ ਤਾਂ ਗਤੀ ਅਤੇ ਊਰਜਾ ਦੇ ਨਾਲ ਆਪਣੇ ਆਪ ਨੂੰ ਖੁੱਲਾ ਅਤੇ ਮੁਕਤ ਮਹਿਸੂਸ ਕਰਦੇ ਹੋ ਵਧੀਆ ਤੇ ਰੁਮਾਨ 'ਚ ਮਹਿਸੂਸ ਹੁੰਦਾ ਹੈ ਜਿਸ ਨਾਲ ਦਿਮਾਗ ਵਿੱਚ ਐਟਰੇਨਾਈਲ ਦਾ ਇੱਕ ਰਸ਼ ਹੁੰਦਾ ਹੈ ਇਹ ਰਸ਼ ਤੁਰੰਤ ਤੁਹਾਡੇ ਦਿਲ ਦੀ ਧੜਕਣ ਨੂੰ ਤੇਜ ਕਰਦਾ ਅਤੇ ਸ਼ਰੀਰ 'ਚ ਬੜੀ ਤਾਕਤ ਮਹਿਸੂਸ ਕਰਦਾ ਹੈ ਕਰਵਾਉਂਦਾ ਹੈ ਇਹ ਇੱਕ ਸੰਦੇਹ ਸੰਦੇਹ ਸਮੇਂ ਦੇ ਨਾਲ ਹੈ ਜੋ ਨਾ ਸਿਰਫ ਮਨੋਭਾਵਨਾ ਨੂੰ ਉੱਚਾ ਕਰਦੀ ਹੈ ਬਲਕਿ ਇਹ ਵੀ ਇੱਕ ਖੁਦ ਅਨੁਭਵ ਬਣ ਜਾਂਦੀ ਹੈ ਜਿਸਤ ਹਰ ਤੁਸ ਜਿੱਥੇ ਹਰ ਦੂਜੀ ਸਿਹਤਮੰਦ ਸਰਗਰਮੀ ਬਿਨਾਂ ਜ਼ਿੰਦਗੀ ਵਿੱਚ ਇੱਕ ਨਵਾਂ ਸਪਸ਼ਟ ਤਜਰਬਾ ਮਿਲਦਾ ਹੈ